ਦਰਅਸਲ ਮੁੰਬਈ ਵਿੱਚ ਅਚਾਨਕ ਹੀ ਮੇਰੇ ਦੋਸਤ ਦੀ ਤਬੀਅਤ ਬਹੁਤ ਖਰਾਬ ਹੋ ਗਈ ਅਤੇ ਉਹਨਾਂ ਨੇ ਮੈਨੂੰ ਬਹੁਤ ਜ਼ਰੂਰੀ ਤੌਰ 'ਤੇ ਬੁਲਾਇਆ ਸੋ ਮੇਰੀ ਅੱਜ ਰਾਤ ਦੀ ਫਲਾਈਟ ਅੰਮ੍ਰਿਤਸਰ ਰਾਜਾ ਸੰਸੀ ਹਵਾਈ ਅੱਡੇ ਤੋਂ ਤਕਰੀਬਨ ਕੋਈ ਬਾਰਾਂ ਕੁ ਵਜੇ ਦੀ ਹੈ ਕੀ ਤੁਹਾਡੇ ਕੋਲ ਕੋਈ ਵੈਨ ਜਾਂ ਆਟੋ ਹੈ ਜੋ ਕਿ ਮੈਨੂੰ ਉਥੋਂ ਤੱਕ ਛੱਡ ਆਵੇ ਮੈਂ ਤਰਨ ਤਾਰਨ ਤੋਂ ਤਕਰੀਬਨ ਨੌਂ ਕੁ ਵਜੇ ਚੱਲਾਂਗਾ ਉੱਥੋਂ ਤੁਸੀਂ ਮੈਨੂੰ ਪਿਕ ਕਰ ਸਕਦੇ ਮੈਨੂੰ ਲੈ ਸਕਦੇ ਹੋ ਮੈਂ ਅੰਦਾਜ਼ਨ ਉੱਥੇ ਦਸ ਕੁ ਵਜੇ ਪਹੁੰਚ ਸਕਦਾ ਹਾਂ ਜੇ ਤੁਹਾਡੇ ਕੋਲ ਕੋਈ ਵੈਨ ਜਾਂ ਆਟੋ ਦੀ ਸਹੂਲਤ ਹੈ ਤਾਂ ਬੜੀ ਮਿਹਰਬਾਨੀ ਹੋਵੇਗੀ